ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਵੈੱਬਸਾਈਟ ਤੋਂ ਇੱਕ ਔਡਰ ਕੀਤਾ ਸੀਗਾ ਬਾਥਿੰਗ ਸੋਪ ਦਾ ਅਤੇ ਮੈਂ ਉਸ ਸੋਪ ਦੇ ਬਾਰੇ ਵਿੱਚ ਆਪਣੇ ਕੁਛ ਪੁਆਇੰਟ ਔਫ ਵਿਊ ਦੇਣਾ ਚਾਹੁੰਦੀ ਸੀਗੀ ਕਿਉਂਕਿ ਮੈਨੂੰ ਜਿਹੜੀ ਡਿਲੀਵਰੀ ਹੈਗੀ ਹੈ ਉਹ ਵੰਨ ਮੰਥ ਦੇ ਵਿੱਚ ਮਿਲੀ ਹੈ ਜਦ ਕਿ ਮੈਨੂੰ ਫਿਫਟੀਨ ਡੇਜ਼ ਦੇ ਵਿੱਚ ਕਿਹਾ ਗਿਆ ਸੀਗਾ ਕਿ ਤੁਹਾਡੀ ਜਿਹੜੀ ਔਡਰ ਉਹਦੀ ਡਿਲੀਵਰੀ ਹੋ ਜਾਵੇਗੀ ਬਟ ਮੈਨੂੰ ਮਿਲੀ ਨਹੀਂ ਹੈਗੀ ਬਹੁਤ ਜ਼ਿਆਦਾ ਲੇਟ ਮਿਲੀ ਹੈ ਅਤੇ ਮੈਂ ਇਸ ਨਾਲੋਂ ਬਿਲਕੁਲ ਵੀ ਖੁਸ਼ ਨਹੀਂ ਹੈਗੀ ਅਤੇ ਜਿਹੜੀ ਪੈਕਿੰਗ ਸੀਗੀ ਉਹ ਤਾਂ ਬਹੁਤ ਹੀ ਜ਼ਿਆਦਾ ਬਕਵਾਸ ਸੀ ਉਹ ਬਿਲਕੁਲ ਵੀ ਅੱਛੀ ਨਹੀਂ ਸੀ ਦੇਖਣ ਨੂੰ ਲੱਗ ਹੀ ਨਹੀਂ ਸੀ ਰਿਹਾ ਕਿ ਮੈਂ ਕਿਸੇ ਅੱਛੀ ਵੈੱਬਸਾਈਟ ਤੋਂ ਜਿਹੜਾ ਹੈ ਉਹ ਔਡਰ ਕੀਤਾ ਹੈ ਅਤੇ ਮੈਂ ਉਹਦੇ ਵਿੱਚ ਬਾਰ੍ਹਾਂ ਸੈਟ ਦਾ ਔਡਰ ਭੇਜ ਕੀਤਾ ਸੀਗਾ ਬਟ ਮੈਨੂੰ ਸਿਰਫ ਚਾਰ ਸੈਟ ਹੀ ਔਡਰ ਜਿਹੜੇ ਹੈ ਉਹ ਰਿਸੀਵ ਹੋਏ ਨੇ ਅਤੇ ਜਿਹੜੀ ਉਹਦੀ ਸੋਪ ਦੀ ਜਿਹੜੀ ਕੁਆਲਿਟੀ ਹੈ ਉਹ ਬਿਲ ਉਹ ਬਿਲਕੁਲ ਹੀ ਘਟੀਆ ਹੈ ਬਹੁਤ ਹੀ ਜ਼ਿਆਦਾ ਹਾਰਸ਼ ਸ਼ੋਪ ਹੈਗਾ ਹੈ ਅਤੇ ਮੇਰੀ ਜਿਹੜੀ ਸਕਿੰਨ ਹੈ ਉਹ ਬਹੁਤ ਜ਼ਿਆਦਾ ਡਰਾਈ ਅਤੇ ਡੈਮਿਜ਼ ਹੋ ਚੁੱਕੀ ਹੈ ਅਤੇ ਇਸ ਕਰਕੇ ਮੈਨੂੰ ਡੋਕਟਰ ਤੋਂ ਵੀ ਕੰਸਲਟ ਕਰਨਾ ਪਿਆ ਅਤੇ ਡੋਕਟਰ ਨੇ ਮੈਨੂੰ ਉਹ ਸੋਪ ਨਾ ਯੂਜ਼ ਕਰਨ ਲਈ ਕਿਹਾ ਹੈ ਅਤੇ ਪਲੀਜ਼ ਤੁਸੀਂ ਮੇਰਾ ਜਿਹੜਾ ਹੈ ਉਹ ਔਡਰ ਹੈ ਜਿਹੜਾ ਉਹ ਵਾਪਸ ਲੈ ਲਓ ਅਤੇ ਉਹਦੇ ਬਦਲੇ ਮੇਰਾ ਜਿਹੜਾ ਰਿਫੰਡ ਹੈ ਉਹ ਮੈਨੂੰ ਬੈਕ ਕਰ ਦਿਉ ਅਤੇ ਬਾਕੀ ਮੈਂ ਕਦੀ ਵੀ ਕਿਸੇ ਨੂੰ ਵੀ ਤੁਹਾਡੀ ਵੈੱਬਸਾਈਟ ਤੋਂ ਕੁਛ ਵੀ ਔਡਰ ਕਰਨ ਦੇ ਲੀਏ ਉਹਨਾਂ ਨੂੰ ਕਦੀ ਵੀ ਨਹੀਂ ਕਹਾਂਗੀ